ਫੋਟੋਗ੍ਰਾਫੀ ਇੱਕ ਆਰਟ ਹੈ ਇੱਕ ਕਲਾ ਹੈ ਜੋ ਕਿ ਅੰਦਰੂਨੀ ਹੈ ਜੋ ਕਿ ਕੁਦਰਤ ਨੂੰ ਜਾਂ ਕਿਸੇ ਮੈਮਰੀ ਵੱਲ ਕੋਈ ਵੀ ਲਮਹਾ ਹੁੰਦਾ ਹੈ ਉਹਨੂੰ ਕੈਦ ਕਰਨ ਵਾਸਤੇ ਇੱਕ ਬਹੁਤ ਹੀ ਸੁੰਦਰ ਅਤੇ ਅਦਭੁਤ ਚੀਜ਼ ਹੈ ਫੋਟੋਗ੍ਰਾਫੀ ਵਿੱਚ ਆਪਾਂ ਉਹ ਸਮਾਂ ਕੈਦ ਕਰ ਸਕਦੇ ਹਾਂ ਜਿਸ ਨੂੰ ਬਹੁਤ ਹੀ ਖੂਬਸੂਰਤ ਮੰਨਿਆ ਜਾਂਦਾ ਹੈ ਜਿਵੇਂ ਕਿ ਬੱਚਿਆਂ ਦੀ ਫੋਟੋ ਕੁਦਰਤੀ ਪੇੜ ਪੌਦੇ ਜੰਤੂ ਜਾਨਵਰ ਕਾਫੀ ਤਰ੍ਹਾਂ ਦੀਆਂ ਤਸਵੀਰਾਂ ਖਿੱਚਣੀਆਂ ਪਹਾੜਾਂ ਦੀ ਬਿਲਡਿੰਗ ਦੀ ਇਹ ਫੋਟੋਗ੍ਰਾਫੀ ਦਾ ਸ਼ੌਂਕ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ ਪਰ ਜਿਸ ਨੂੰ ਹੁੰਦਾ ਹੈ ਉਸ ਨੂੰ ਖੁਮਾਰ ਫੋਟੋਗ੍ਰਾਫੀ ਦਾ ਇਸ ਤਰ੍ਹਾਂ ਚੜ ਜਾਂਦਾ ਹੈ ਕਿ ਉਹ ਹਰ ਤਰ੍ਹਾਂ ਦੇ ਲਮਹੇ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਫੋਟੋਗ੍ਰਾਫੀ ਲਗਭਗ ਵਿਆਹ ਸ਼ਾਦੀਆ ਫੰਕਸ਼ਨਾਂ ਦੇ ਵਿੱਚ ਕੀਤੀ ਜਾਂਦੀ ਹੈ ਉਸ ਤੋਂ ਇਲਾਵਾ ਫੋਟੋਗ੍ਰਾਫੀ ਵੈਲਡ ਜੰਗਲ ਵਿੱਚ ਵਿਲਡ ਲਾਈਫ ਜੰਗਲਾਂ ਦੇ ਵਿੱਚ ਪੰਕਸ਼ੀਆਂ ਦੀ ਜਾਨਵਰਾਂ ਦੀ ਪੇੜ ਪੌਦਿਆਂ ਦੀ ਫੁੱਲਾਂ ਦੀ ਅਤੇ ਅੱਜ ਕੱਲ੍ਹ ਫੋਟੋਗ੍ਰਾਫੀ ਅੰਡਰ ਵਾਟਰ ਵੀ ਹੋਣ ਲੱਗ ਗਈ ਜੋ ਕਿ ਬਹੁਤ ਹੀ ਖੂਬਸੂਰਤ ਨਜ਼ਾਰਾ ਸਾਨੂੰ ਪਾਣੀ ਦੇ ਅੰਦਰ ਦਾ ਦੇਖਣ ਨੂੰ ਮਿਲਦਾ ਹੈ